ਹੈਲੋ ਹਾਂਜੀ ਹਾਂਜੀ

ਹਾਂਜੀ ਹਾਂਜੀ ਮੈਂ ਡੋਕਟਰ ਸੰਦੀਪ ਬੋਲ ਰਹੀ ਆਂ

ਅੱਛਾ ਦੰਦ ਚ ਦਰਦ ਹੋ ਰਿਹਾ ਕੀੜਾ ਕੁੜਾ ਹੋਊਗਾ ਦੰਦ ਚ ਹਾਂਜੀ ਹਾਂਜੀ ਇਹ ਵੀ ਹਾਂਜੀ ਇਹ ਪਤਾ ਕੀ ਹੁੰਦਾ ਕਈ ਵਾਰੀ ਦੰਦਾਂ ਚ ਆਪਣੇ ਰੇਸ਼ਾ ਵੀ ਹੁੰਦਾ ਨਾ ਉਸ ਕਰਕੇ ਫਿਰ ਹੋ ਸਕਦਾ ਇਹ ਫਿਰ ਆਪਾਂ ਨੂੰ ਐ ਰਿਟਨ ਕਰਨ ਤਾਂ ਨਹੀਂ ਜਾਵੇਗਾ ਇਹਦੇ ਕਰਕੇ ਹੋਈ ਜਾਂਦਾ ਤੇ ਇਹ ਤਾਂ ਫਿਰ ਤੁਹਾਨੂੰ ਇਹ ਇੱਕ ਵਾਰੀ ਇਥੇ ਆਉਣਾ ਪਊਗਾ ਫਿਰ ਮਤਲਬ ਚੈੱਕ ਕਰਕੇ ਪਤਾ ਲੱਗੂਗਾ ਤੇ ਜੇ ਪ੍ਰੋਬਲਮ ਭੈਣ ਤੁਸੀ ਤੁਸੀਂ ਐਥੇ ਆਹ ਕਰਾ ਹੋਵੇ ਤੁਹਾਡੀ ਅਪੋਇੰਟਮੈਂਟ ਹੋਜੂਗੀ ਪਰਚੀ ਕਰਾਉਣੀ ਪਊਗੀ ਤੁਹਾਨੂੰ ਫਿਰ ਤੁਹਾਡੇ ਉਸ ਹਿਸਾਬ ਨਾਲ ਹੋਜੇਗੀ ਫਿਰ ਈ ਪਤਾ ਲੱਗ ਜਾਦਾ ਕੀ ਪ੍ਰੋਬਲਮ ਆ ਕੋਈ ਹਾਂਜੀ ਤੁਸੀਂ ਬਸ ਹਲਕੀਆਂ ਚੀਜ਼ਾਂ ਜਿਵੇਂ ਦਹੀਂ ਜਾਂ ਦੁੱਧ ਲੈ ਲੋ ਜਿਵੇਂ ਹਲਕੀ ਚੀਜ਼ ਹੋਏ ਜਿਵੇਂ ਨਾ ਚਵਾਉਣੀ ਨਾ ਪਵੇ ਉਹ ਚੀਜ਼ ਲੈ ਸਕਦੇ ਆ ਜਿਵੇਂ ਤੇ ਤੁਸੀਂ ਪੇਸਟ ਵੀ ਸਹੀ ਢੰਗ ਦਾ ਆਹ ਕਰਨਾ ਉਹ ਪੇਸਟ ਦੇ ਕਾਰਨ ਵੀ ਹੋ ਸਕਦਾ ਹੁੰਦਾ ਜਿਵੇਂ ਆਪਣਾ ਪੇਸਟ ਹੁੰਦਾ ਨਾ ਉਹ ਵੀ ਥੋੜਾ ਜਿਹਾ ਸਹੀ ਹੋਣਾ ਚਾਹੀਦਾ ਸੈਂਸੋ ਸੈ ਸੈਂਸੋਡਾਈਨ ਸੈਂਸੋਡਾਈਨ ਉਹ ਵੀ ਥੋੜਾ ਜਿਹਾ ਚਾਹੀਦਾ ਤੇ ਹਾਂਹਾਂ ਉਹਦੇ ਲਈ ਆਪਣੇ ਕੋਲ ਵੀ ਹੈਗੇ ਆ ਉਹ ਪੇਸਟ ਸਹੀ ਤਰਾਂ ਦੇ ਉਹ ਕਰ ਸਕਦੇ

ਹਾਂ ਬਸ ਉਹ ਤਾਂ ਕੋਈ ਗੱਲ ਨਹੀਂ ਫਿਰ ਮੈਡੀਸਨ ਨਾਲ ਹੀ ਠੀਕ ਹੋਊਗਾ ਕੁਛ ਮਤਲਵ ਪੇਸਟ ਦਾ ਨਾਲ ਹੀ ਹੈ ਜਿਹੋ ਜਿਹਾ ਮੈਡੀਸਨ ਨਾਲੇ ਠੀਕ ਹੋ ਸਕਦਾ ਐਂ ਵੀ ਤਾਂ ਫਿਰ ਹੁਣ ਕਹਿ ਨਹੀਂ ਸਕਦੇ ਹੋਊਗਾ ਦਰਦ ਫੀਸ ਤਾਂ ਕੋਈ ਗੱਲ ਨੀ ਐਨੀ ਹੈ ਨੀ ਜੀ ਕੋਈ ਗੱਲ ਨੀ ਇੱਥੇ ਆ ਕੇ ਆਨੀ ਹੈਨੀ ਗੀ ਫੀਸ ਹਾਂ ਕੋਈ ਗੱਲ ਨੀ ਆਜੋ ਕੋਈ ਗੱਲ ਨੀ ਚੈੱਕ ਕਰਕੇ ਦੱਸ ਦਿੰਦੇ ਕੀ ਪ੍ਰੋਬਲਮ ਆ ਸਹੀ ਹੋਜੂ ਠੀਕ ਆ